ਭੰਗੜਾ ਸਾਡੇ ਪੰਜਾਬੀਆਂ ਦੀ ਆਨ ਬਾਨ ਸ਼ਾਨ ਹੈ ਅਤੇ ਭੰਗੜਾ ਪੰਜਾਬ ਦੇ ਗੱਭਰੂ ਮੁਟਿਆਰਾਂ ਪਾਉਂਦੇ ਹਨ ਅਤੇ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਪਹਿਰਾਵਾ ਪਹਿਨਿਆ ਜਾਂਦਾ ਹੈ ਜਿਵੇਂ ਕਿ ਗੱਭਰੂ ਪਹਿਨਦੇ ਹਨ ਚਾਦਰਾ ਕੁੜਤਾ ਜੈਕਟ ਕੈਂਠਾ ਅਤੇ ਪੱਗ ਬੰਨਦੇ ਹਨ ਅਤੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਹਨ ਇਸ ਤਰ੍ਹਾਂ ਹੀ ਮੁਟਿਆਰਾਂ ਲਹਿੰਗਾ ਚੋਲੀ ਪਹਿਨਦੀਆਂ ਹਨ ਜਾਂ ਸਲਵਾਰ ਕਮੀਜ ਜੈਕੇਟ ਗਹਿਣੇ ਗੱਟੇ ਲਾਉਂਦੀਆਂ ਹਨ ਸੱਗੀ ਫੁੱਲ ਲਾਉਂਦੀਆਂ ਹਨ ਅਤੇ ਫੁਲਕਾਰੀ ਲੈਂਦੀਆਂ ਹਨ ਆਪਣਾ ਮੇਕਅਪ ਕਰਦੀਆਂ ਹਨ ਅਤੇ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਹਨ ਇਹਨਾਂ ਦਾ ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ ਭੰਗੜਾ ਤਕਰੀਬਨ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਪਾਇਆ ਜਾਂ ਨੱਚਿਆ ਜਾਂਦਾ ਹੈ ਜਿਨਾਂ ਨੂੰ ਜਿਨਾਂ ਨੂੰ ਤਕਰੀਬਨ ਆਪਾਂ ਖੁਸ਼ੀ ਦੇ ਮੌਕੇ 'ਤੇ ਕਹਿ ਸਕਦੇ ਹਾਂ ਪਿਛਲੇ ਮਹੀਨੇ ਜਦੋਂ ਮੈਂ ਵਿਆਹ 'ਤੇ ਗਈ ਸੀ ਉੱਥੇ ਮੈਨੂੰ ਭੰਗੜੇ ਭੰਗੜੇ ਵਾਲੇ ਮੁੰਡੇ ਅਤੇ ਗਿੱਧੇ ਵਾਲੀਆਂ ਕੁੜੀਆਂ ਮਿਲੀਆਂ ਸਨ ਉਹਨਾਂ ਦਾ ਇੰਨਾ ਸੋਹਣਾ ਚਾ ਇੰਨਾ ਸੋਹਣਾ ਪਹਿਰਾਵਾ ਦੇਖਿਆ ਤਾਂ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਇੰਨਾ ਵਧੀਆ ਨੱਚਦੇ ਹਨ ਭੰਗੜਾ ਪਾਉਂਦੇ ਹਨ ਕਿ ਮਨ ਖੁਸ਼ੀ ਨਾਲ ਉੱਠਦਾ ਹੈ ਅਤੇ ਲੰਮੀ ਘਣ ਨਾਲ ਕੜੀ ਮਿਹਨਤ ਕਹਿੰਦੇ ਕਰਦੇ ਹਨ ਅਤੇ ਉਹ ਇੰਨਾ ਜ਼ਿਆਦਾ ਖੁਸ਼ ਹੁੰਦੇ ਹਨ ਹੱਸਦੇ ਖੇਡਦੇ ਹਨ ਆਪ ਸਾਡੇ ਮਨਾਂ ਨੂੰ ਬਹੁਤ ਜ਼ਿਆਦਾ ਹਸ਼ ਅੱਕਕਿ ਆਕਰਸ਼ਿਤ ਕਰਦੇ ਹਨ ਆਕਰਸ਼ਿਤ ਕਰਦੇ ਹਨ ਅਤੇ ਭੰਗੜੇ ਵਿੱਚ ਬਹੁਤ ਜ਼ਿਆਦਾ ਸਟੈਪ ਹੁੰਦੇ ਹਨ ਆਮ ਵੀ ਸਟੈਪ ਹੁੰਦੇ ਹਨ ਆਮ ਸਟੈਪ ਜਿਵੇਂ ਕਿ ਝੂਮਰ ਲੁੱਡੀ ਧਮਾਲ ਮਿਰਜ਼ਾਂ ਇਸ ਤਰ੍ਹਾਂ ਦੇ ਕੁਝ ਸਟੈਪ ਹੁੰਦੇ ਹਨ ਅਤੇ ਇੰਨਾ ਜ਼ਿਆਦਾ ਖੁਸ਼ੀ ਨਾਲ ਭੰਗੜਾ ਪਾਇਆ ਜਾਂਦਾ ਹੈ ਬਹੁਤ ਜ਼ਿਆਦਾ ਹੀ ਖੁਸ਼ੀ ਹੁੰਦੀ ਹੈ ਭੰਗੜਾ ਭੰਗੜੇ ਦਾ ਪ੍ਰਦਰਸ਼ਨ ਲਈ ਬਹੁਤ ਜ਼ਿਆਦਾ ਲੋਕ ਸਾਡੇ ਪੰਜਾਬ ਵਿੱਚ ਭੰਗੜਾ ਪਾਇਆ ਜਾਂਦਾ ਅੱਜ ਕੱਲ੍ਹ ਤਾਂ ਬਾਹਰ ਦੇ ਲੋਕ ਵੀ ਭੰਗੜੇ ਭੰਗੜੇ ਨਾਲ ਭੰਗੜਾ ਪਾਉਂਦੇ ਹਨ ਅਤੇ ਇੰਨਾਂ ਜ਼ਿਆਦਾ ਖੁਸ਼ ਹੁੰਦੇ ਹਨ